ਅਸੀਂ ਜਾਣਦੇ ਹਾਂ ਕਿ ਹਰ ਇਨਸਾਨ ਦੀ ਆਪਣੀ ਆਪਣੀ ਰੁਚੀ ਹੁੰਦੀ ਹੈ ਹਰੇਕ ਇਨਸਾਨ ਦੇ ਆਪਣੇ ਸ਼ੌਂਕ ਹਨ ਸੋ ਉਹ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਆਪਣੇ ਵਿਹਲੇ ਸਮੇਂ ਨੂੰ ਵਰਤੋਂ ਵਿੱਚ ਲਿਆਉਂਦੇ ਹਾਂ ਕੁਝ ਲੋਕਾਂ ਨੂੰ ਉਹਨਾਂ ਦੇ ਸ਼ੌਂਕ ਦੇ ਅਨੁਸਾਰ ਹੀ ਕੰਮ ਮਿਲ ਜਾਂਦਾ ਆ ਅਤੇ ਉਹ ਆਪਣਾ ਸ਼ੌਂਕ ਬੜੇ ਆਰਾਮ ਦੇ ਨਾਲ ਕਰ ਪਾਉਂਦੇ ਆ ਕੁਝ ਨੂੰ ਜ਼ਿੰਦਗੀ ਗੁਜ਼ਾਰਨ ਲਈ ਆਪਣੇ ਸ਼ੌਂਕ ਨੂੰ ਮਾਰ ਕੇ ਕਈ ਹੋਰ ਤਰ੍ਹਾਂ ਦੇ ਕਾਰੋਬਾਰ ਕਰਕੇ ਆਪਣਾ ਨਿਰਬਾਹ ਕਰਨਾ ਪੈਂਦਾ ਆ ਮੈਨੂੰ ਛੋਟੇ ਹੁੰਦੇ ਤੋਂ ਹੀ ਗਾਣਾ ਗਾਉਣ ਦਾ ਬਹੁਤ ਸ਼ੌਂਕ ਸੀ ਮੈਂ ਕਦੇ ਕਦੇ ਗਾਣੇ ਗੁਣਗੁਣਾਉਂਦਾ ਵੀ ਰਹਿੰਦਾ ਸੀ ਜ਼ਿਆਦਾਤਰ ਉੱਨੀ ਸੌ ਅੱਸੀ ਤੋਂ ਲੈ ਕੇ ਉੱਨੀ ਸੌ ਪਚਾਨਵੇਂ ਤੱਕ ਦੀਆਂ ਹਿੰਦੀ ਫਿਲਮਾਂ ਦੇ ਗਾਣੇ ਬਹੁਤ ਹੀ ਚੰਗੇ ਲੱਗਦੇ ਸੀ ਅਤੇ ਬਾਥਰੂਮ ਵਿੱਚ ਮੈਂ ਜ਼ਿਆਦਾ ਗਾਣੇ ਗਾਉਂਦਾ ਰਿਹਾ ਹਾਂ ਔਰ ਮੈਨੂੰ ਗਾਣੇ ਸੁਣਨਾ ਬਹੁਤ ਚੰਗਾ ਲੱਗਦਾ ਆ ਮੇਰੇ ਮਤਲਬ ਇੱਕ ਰੂਹ ਨੂੰ ਜਿਸ ਤਰ੍ਹਾਂ ਸ਼ਾਂਤੀ ਮਿਲ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਆ ਮੈਨੂੰ ਕਿਸ਼ੋਰ ਕੁਮਾਰ ਦੇ ਗਾਣੇ ਬਹੁਤ ਪਸੰਦ ਲੱਗਦੇ ਆ ਅਗਰ ਮੈਂ ਘਰ 'ਚ ਕਦੇ ਇਕੱਲਾ ਹੋਵਾਂ ਤਾਂ ਮੈਂ ਕਿਸ਼ੋਰ ਕੁਮਾਰ ਦੇ ਗਾਣੇ ਬਹੁਤ ਸੁਣਦਾ ਹਾਂ ਕਿ ਜਿਹੜਾ ਕਿ ਮੇਰੀ ਆਤਮਾ ਨੂੰ ਇੱਕਦਮ ਐਨ ਸ਼ਾਂਤੀ ਸਕੂਨ ਮਿਲ ਜਾਂਦਾ ਹੈ ਕਿਸ਼ੋਰ ਕੁਮਾਰ ਦੀ ਆਵਾਜ਼ ਇੰਨੀ ਕੁ ਪਿਆਰੀ ਲੱਗਦੀ ਹੈ ਕਿ ਜਿਸ ਤਰ੍ਹਾਂ ਮਨ ਨੂੰ ਸੰਤੁਸ਼ਟੀ ਜਿਹੀ ਹੋ ਜਾਂਦੀ ਹੈ ਕਿ ਗਾਣਾ ਸੁਣ ਕੇ ਮਨ ਨੂੰ ਸੰਤੁਸ਼ਟੀ ਹੋ ਜਾਂਦੀ ਆ ਹੋਰ ਵੀ ਗਾਇਕ ਮੁਹੰਮਦ ਰਫੀ ਮੁਕੇਸ਼ ਉਹਨਾਂ ਦੇ ਵੀ ਗਾਣੇ ਬਹੁਤ ਵਧੀਆ ਆ ਪਰ ਕਿਸ਼ੋਰ ਕੁਮਾਰ ਦੇ ਗਾਣੇ ਮੈਨੂੰ ਬਹੁਤ ਚੰਗੇ ਲੱਗਦੇ ਆ ਅੱਜ ਕੱਲ੍ਹ ਤਾਂ ਹੁਣ ਪੰਜਾਬੀ ਸੰਗੀਤ ਨੇ ਵੀ ਬਹੁਤ ਹੀ ਮੱਲਾਂ ਮਾਰੀਆਂ ਨੇ ਉਹਨਾਂ ਦੇ ਵਿੱਚ ਵੀ ਕੁਛ ਗਾਇਕ ਤਾਂ ਬਹੁਤ ਸਿੱਖਰਾਂ 'ਤੇ ਆ ਉਹਨਾਂ ਵਿੱਚੋਂ ਪੰਜਾਬੀ ਗਾਣਿਆਂ ਦੇ ਵਿੱਚੋਂ ਵੀ ਮੈਨੂੰ ਗੁਰਦਾਸ ਮਾਨ ਜੀ ਦੇ ਗਾਣੇ ਬਹੁਤ ਪਸੰਦ ਆ ਉਹਨਾਂ ਦੇ ਗਾਣਿਆਂ ਦੇ ਵਿੱਚ ਕੁਛ ਮਤਲਬ ਮਤਲਬ ਨਿਕਲਦਾ ਆ ਕੁਛ ਗਾਣਿਆਂ ਦਾ ਕੁਛ ਅਸ਼ਲ ਅਸ਼ਲੀਲਤਾਵਾਂ ਵਿੱਚ ਕੁਛ ਨਹੀਂ ਹੈਗੀਆਂ ਤੁਸੀਂ ਆਰਾਮ ਨਾਲ ਘਰ 'ਚ ਬੈਠ ਕੇ ਗਾਣੇ ਸੁਣ ਸਕਦੇ ਹੋ ਉਹਨਾਂ ਦੇ ਗੀਤਾਂ ਦੇ ਵਿੱਚ ਲੱਚਰਪੁਣਾ ਕੋਈ ਨਹੀਂ ਹੈ ਔਰ ਗਾਣਿਆਂ ਦਾ ਕੁਛ ਮਤਲਬ ਨਿਕਲਦਾ ਆ ਨਹੀਂ ਤਾਂ ਕਈ ਹੋਰ ਗਾਇਕ ਜਿਹੜੇ ਆ ਉਹਨਾਂ ਦੇ ਗਾਣਿਆਂ ਦਾ ਤਾਂ ਕੁਛ ਮਤਲਬ ਹੀ ਨਹੀਂ ਨਿਕਲਦਾ ਉਹ ਤਾਂ ਕੁਛ ਲੱਚਰ ਵੀ ਗਾਣੇ ਆ ਕੁਛ ਅਸੀਂ ਟੀਵੀ 'ਤੇ ਬਹਿ ਘਰੇ ਬੈਠੇ ਦੇਖ ਨਹੀਂ ਸਕਦੇ ਸੋ ਮੈਨੂੰ ਕਿਸ਼ੋਰ ਕੁਮਾਰ ਦੇ ਗਾਣੇ ਬਹੁਤ ਵਧੀਆ ਲੱਗਦੇ ਨੇ ਗੁਰਦਾਸ ਮਾਨ ਜੀ ਦੇ ਗਾਣੇ ਬਹੁਤ ਵਧੀਆ ਲੱਗਦੇ ਨੇ ਮੈਂ ਇਹਨਾਂ ਨੂੰ ਬਹੁਤ ਪਸੰਦ ਕਰਦਾ ਹਾਂ